ਮੈਂ ਮੀਸ਼ੋ ਤੋਂ ਫਸਟ ਪ੍ਰੋਡਕਟ ਸੂਟ ਆਰਡਰ ਕੀਤਾ ਸੂਟ ਮੇਰਾ ਬਹੁਤ ਵਧੀਆ ਕੁਆਲਿਟੀ ਦਾ ਆਇਆ ਅਤੇ ਸੂਟ ਦਾ ਰੰਗ ਵੀ ਬਹੁਤ ਵਧੀਆ ਸੀ ਸੈਕਿੰਡ ਪ੍ਰੋਡਕਟ ਮੈਂ ਹੈਡਫੋਨ ਮੰਗਵਾਏ ਪਰ ਹੈਡਫੋਨ ਦੀ ਵਾਇਰ ਖ਼ਰਾਬ ਅਤੇ ਕੱਟੀ ਹੋਈ ਸੀ ਹੈਡਫੋਨ ਵਿੱਚ ਆਵਾਜ਼ ਸਾਫ਼ ਨਹੀਂ ਆ ਰਹੀ ਸੀ ਉਸ ਪ੍ਰੋਡਕਟ ਦੀ ਕੁਆਲਿਟੀ ਚੰਗੀ ਨਹੀਂ ਸੀ ਉਸ ਪ੍ਰੋਡਕਟ ਦੇ ਬੋਕਸ ਦਾ ਹਾਲ ਵੀ ਸਹੀ ਨਹੀਂ ਸੀ ਉਹ ਪ੍ਰੋਡਕਟ ਮੈਨੂੰ ਪਸੰਦ ਨਹੀਂ ਆਇਆ